ਹੈਲੋ ਹੈਲੋ ਓ ਪੰਕਜ ਪੰਕਜ ਬੋਲ ਰਿਹਾ ਅੱਛਾ ਹੋਰ ਕਿਵੇਂ ਕੀ ਹਾਲ ਹੈ ਵਧੀਆ ਵਧੀਆ ਆ ਗਿਆ ਕਿ ਓ ਯਾਰ ਵੇਖਿਆ ਹੀ ਨਹੀਂ ਮੈਂ ਤਾਂ ਯਾਰ ਅੱਛਾ ਕਲੀਅਰ ਹੋ ਗਈ ਇਸ ਵਾਰੀ ਓ ਯਾਰ ਸਪਲੀ ਆ ਜਾਂਦੀ ਆ ਤੈਨੂੰ ਪਤਾ ਤਾਂ ਹੈ ਯਾਰ ਹਰ ਵਾਰੀ ਇੱਕ ਅੱਧੀ ਆ ਹੀ ਜਾਂਦੀ ਠੀਕ ਹੈ ਠੀਕ ਹੈ ਓ ਵਧੀਆ ਯਾਰ ਹਾਂ ਯਾਰ ਪੰਕਜ ਵੈਸੇ ਨਾ ਪੰਕਜ ਵੈਸੇ ਮੈਂ ਵੀ ਇਹੀ ਸੋਚ ਰਿਹਾ ਸੀ ਮੈਂ ਕਿਹਾ ਯਾਰ ਮਾਸਟਰ ਕਰਨ 'ਚ ਕੋਈ ਫਾਇਦਾ ਨਹੀਂ ਹੈ ਜਿਹੜੇ ਆਪਾਂ ਉਹ ਦੋ ਸਾਲ ਮਾਸਟਰ 'ਚ ਲਾਵਾਂਗੇ ਨਾ ਸ਼ਾਇਦ ਇੱਥੇ ਲਾਏ ਗੱਲ ਬਣ ਜੂਗੀ ਹੈ ਨਾ ਅਤੇ ਅੱਛਾ ਨਹੀਂ ਫਾਇਲ ਕਿਉਂ ਨਹੀਂ ਹੋ ਸਕਦੀ ਕਿ ਲੈਵਲ ਲੈਵਲ ਨਹੀਂ ਹੈ ਕਿ ਮਤਲਬ ਹੈ ਹੀ ਨਹੀਂ ਕੋਚਿੰਗ ਹੀ ਨਹੀਂ ਹੈ ਅੱਛਾ ਅੱਛਾ ਅੱਛਾ ਅੱਛਾ ਅੱਛਾ ਅੱਛਾ ਚਲੋ ਵਧੀਆ ਕੀਤਾ ਯਾਰ ਇਹ ਤਾਂ ਅੱਛਾ ਅੱਛਾ

ਅੱਛਾ ਨਾ ਲੱਗੇ ਤਾਂ ਵਾਪਿਸ ਅੱਛਾ ਅੱਛਾ ਅੱਛਾ ਅੱਛਾ ਜੀ ਅੱਛਾ ਜੀ ਫੇਰ ਅੱਗੇ ਜੀ ਮੈਂ ਤਾਂ ਯਾਰ ਸੋਚ ਰਿਹਾ ਕਿ ਨਹੀਂ ਕੋਚਿੰਗ ਤਾਂ ਵੀ ਲੈ ਲਈਏ ਯਾਰ ਅਤੇ ਇਹਨਾਂ ਤੋਂ ਤਾਂ ਮਿਲ ਜੇ ਕੀ ਬਠਿੰਡੇ ਜਾਣਾ ਹੀ ਪਵੇਗਾ ਫੇਰ ਹੈਲੋ ਵਾ ਤੇਰੀ ਆਵਾਜ਼ ਨਹੀਂ ਆ ਰਹੀ ਯਾਰ ਹੈਲੋ ਹਾਂਜੀ ਹਾਂਜੀ ਬੋਲੋ ਮੈਂ ਕਿਹਾ ਆਵਾਜ਼ ਥੋੜ੍ਹੀ ਜਿਹੀ ਨਾ ਦੱਬ ਗਈ ਸੀ ਮੈਂ ਕਿਹਾ ਕੋਈ ਨਹੀਂ ਬਿੰਡੇ ਬਠਿੰਡੇ ਚਲਦੇ ਰਹਾਂਗੇ ਆਪਾਂ ਐਂ ਕਰ ਲਵਾਂਗੇ ਜਿਵੇਂ ਤੂੰ ਕਹੇਗਾ ਆਪਾਂ ਉਵੇਂ ਕਰ ਲਵਾਂਗੇ ਅਤੇ ਨਾਨਕਾ ਨੇੜੇ ਆ ਕਿ ਦੂਰ ਹੈ ਅੱਛਾ ਅੱਛਾ ਫੇਰ ਆਪਾਂ ਬਠਿੰਡੇ ਹੀ ਰਹਿ ਲਵਾਂਗੇ ਫੇਰ ਯਾਰ ਹਮ ਹਾਂ ਅਰੋੜਾ ਕਲਾਸਿਸ ਵੈਸੇ ਜ਼ਿਆਦਾ ਹੈ ਯਾਰ ਹਾਂ ਮੈਂ ਵੀ ਸੁਣਿਆ ਇਹ ਤਾਂ ਕੋਪਿਲ ਦਾ ਨਾਂ ਪਹਿਲੀ ਵਾਰ ਸੁਣਿਆ ਮੈਂ ਖੈਰ ਵੈਸੇ ਪਰ ਚਲੋ ਵੇਖ ਲਵਾਂਗੇ ਜਾ ਕੇ ਈ ਪਤਾ ਲੱਗੇਗਾ ਹੈ ਨਾ

ਸਾਰੇ ਹੀ ਪਤਾ ਕਰ ਲਿਆ ਤੂੰ ਚਲੋ ਵਧੀਆ ਯਾਰ ਇਹ ਵੀ ਥੋੜ੍ਹਾ ਵਧੀਆ ਹੋ ਜਾਂਦਾ ਬੰਦਾ ਨਾ ਪਹਿਲੇ ਹੀ ਪਤਾ ਲੱਗ ਜੇ ਨਾ ਥੋੜ੍ਹਾ ਕੰਮ ਸੌਖਾ ਹੋ ਜਾਂਦਾ ਨਾ ਹੈ ਨਾ ਚਲੋ ਵਧੀਆ ਆ ਯਾਰ ਹਮ ਅੱਛਾ ਹਾਂ ਉਹ ਤਾਂ

ਅੱਛਾ ਚਲ ਇਹ ਤਾਂ ਵਧੀਆ ਹੋਇਆ ਫੇਰ

ਤਾਂ ਹੀ ਪਤਾ ਲੱਗਿਆ ਕੰਪੀਟੀਸ਼ਨ ਕਿੰਨਾ ਕੁ ਹੈ ਸ਼ਹਿਰ 'ਚ ਰਹਿ ਕੇ ਤਾਂ ਪਤਾ ਨਹੀਂ ਲਗਦਾ ਯਾਰ ਇੱਕ ਤਾਂ ਹਫਤਾ ਜਿਹੜੀ ਡੈ ਹਫਤੇ ਦੀ ਡੈਮੋ ਫ੍ਰੀ ਹੈਗੇ ਹਾਂ ਪਕ ਹਾਂ ਉਹ ਚਲਦੇ ਆਪਾਂ ਕ ਬਠਿੰਡੇ ਹੀ ਜਾ ਆਉਣਾ ਨੇੜੇ ਹੀ ਹੈ ਟਰੇਨ 'ਚ ਜਾ ਆਨੇ ਹਾਂ ਆਪਾਂ ਫ੍ਰੀ ਹਾਂ ਹੁਣ ਤਾਂ ਹਾਂ ਕੋਈ ਨਹੀਂ ਕੋਈ ਨਹੀਂ ਜਿਵੇਂ ਤੂੰ ਕਹੇਗਾ ਆਪਾਂ ਉਵੇਂ ਕਰ ਲਵਾਂਗੇ ਯਾਰ ਕ ਕੀ ਕੋਚਿੰਗ ਲੈਣੀ ਆ ਆਪਾਂ ਖੈਰ ਫਿਰ ਠੀਕ ਠੀਕ ਠੀਕ ਹੈ ਠੀਕ